ਪੰਜਾਬ ਵਿੱਚ ਅਜਿਹੀਆਂ ਬਹੁਤ ਸਾਰੀਆਂ ਇਕਾਈਆਂ ਹਨ ਜੋ ਕਿ ਉਦਯੋਗਾਂ ਨੂੰ ਉਤਸ਼ਾਹਿਤ ਪਹਿਲਕਦਮੀ ਕਰਦੀਆਂ ਹਨ ਇਹਨਾਂ 'ਚ ਪੰਜਾਬ ਨੈਸ਼ਨਲ ਬੈਂਕ ਸਟੇਟ ਬੈਂਕ ਆਫ ਇੰਡੀਆ ਆਈ ਸੀ ਆਈ ਸੀ ਬੈਂਕ ਐਚ ਡੀ ਐਫ ਸੀ ਬੈਂਕ ਐਲ ਆਈ ਸੀ ਆਫ ਇੰਡੀਆ ਅਤੇ ਹੋਰ ਬਹੁਤ ਸਾਰੇ ਬੈਂਕਿੰਗ ਸੈਕਟਰ ਹਨ ਅਤੇ ਬੀਮਾ ਖੇਤਰ ਹਨ ਜਿਹੜੇ ਕਿ ਉਦਯੋਗਾਂ ਨੂੰ ਕਾਫੀ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੇ ਇਹ ਕਾਫੀ ਆਸਾਨ ਕਿਸ਼ਤਾਂ 'ਤੇ ਲੋਨ ਉਪਲਬਧ ਕਰਵਾਉਂਦੇ ਹਨ ਅਤੇ ਇਹਨਾਂ ਨੇ ਆਪਣੀ ਨੀਤੀਆਂ ਵਿੱਚ ਹੁਣ ਥੋੜ੍ਹਾ ਬਦਲਾਵ ਵੀ ਕੀਤਾ ਹੈ ਤਾਂ ਜੋ ਆਰਾਮ ਨਾਲ ਉਦਯੋਗਾਂ ਨੂੰ ਅਗਰ ਕੋਈ ਦਿੱਕਤ ਹੁੰਦੀ ਹੈ ਤਾਂ ਉਹਨਾਂ ਤੋਂ ਬਚਾਉਣ ਵਾਸਤੇ ਲੋ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਲੋਨ ਉਪਲਬਧ ਕਰਵਾਉਂਦੀਆਂ ਹਨ ਪੰਜਾਬ ਦੀਆਂ ਬਹੁਤ ਸਾਰੀਆਂ ਏਜੰਸੀਆਂ ਉਦਯੋਗਾਂ ਦੇ ਉਤਸ਼ਾਹ ਵਾਸਤੇ ਫੰਡਿੰਗ ਵੀ ਕਰਦੀਆਂ ਹਨ ਘੱਟ ਵਿਆਜ 'ਤੇ ਲੋਨ ਵੀ ਦਿੰਦੀਆਂ ਹਨ